ਹੈਲੋ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਦੱਸੋ ਕੁਛ ਨਹੀਂ ਬਸ ਵਿਹਲੇ ਨਹੀਂ ਨਹੀਂ ਅਜੇ ਕਣਕ ਦੀ ਬਿਜਾਈ ਚਲਦੀ ਪਈ ਹੈ ਕਟਾਈ ਹਾਂਜੀ ਹਾਂਜੀ ਕੰਬਾਈਨਾਂ ਨਾਲ ਅੱਧੀ ਹੱਥ ਨਾਲ ਅੱਧੀ ਕੰਬਾਈਨ ਨਾਲ ਹਾਂ ਹਾਂਜੀ ਵੀਹ ਪੱਚੀ ਹਾਂਜੀ ਹਾਂਜੀ ਹੁਣ ਸਪ੍ਰੇਹਾਂ ਸੁਪਰੇਹਾਂ ਵਰਤੀਆਂ ਜਾਂਦੀਆਂ ਨਾ ਉਹਦੇ ਕਰਕੇ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਕਿਵੇਂ ਹਾਂਜੀ ਹਾਂਜੀ ਇੱਧਰ ਵੀ ਹੈਗੀ ਹਾਂਜੀ ਸਪ੍ਰੇਹਾਂ ਵਰਤੀਆਂ ਜਾਂਦੀਆਂ ਨਾ ਅੱਜ ਕੱਲ੍ਹ ਉਹਦੇ ਕਰਕੇ ਵੀ ਕੁਝ ਹੋ ਜਾਂਦਾ ਔਰਗੈਨਿਕ ਹੀ

ਹਾਂਜੀ ਹਾਂ ਹਾਂਜੀ ਹੋਰ ਇੱਧਰ ਕਪਾਹ ਹੋ ਗਈ ਜੀਰੀ ਜੂਰੀ ਹੋ ਗਈ ਹਾਂਜੀ ਆਲੂਆਂ ਵਗੈਰਾ ਦੀ ਬਿਜਾਈ ਕੀਤੀ ਜਾਂਦੀ ਹੈ ਕਣਕ ਤੋਂ ਬਾਅਦ ਜੀਰੀ ਦੀ

ਹਾਂਜੀ ਹਾਂਜੀ ਵਧੀਆ ਸਰ ਤੁਸੀਂ ਦੱਸੋ ਠੀਕ ਹੈ ਜੀ ਓਕੇ